ਪੰਜਾਬੀ ਭਾਸ਼ਾ ਬਹੁਤ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਇਸ ਭਾਸ਼ਾ ਵਿੱਚ ਬਹੁਤ ਸਾਹਿਤ ਰਚਿਆ ਗਿਆ ਇਹ ਭਾਸ਼ਾ ਬਹੁਤ ਹੀ ਪੁਰਾਤਨ ਅਤੇ ਵਿਕਸਿਤ ਭਾਸ਼ਾ ਹੈ ਪੰਜਾਬੀ ਭਾਸ਼ਾ ਵਿੱਚ ਸਾਹਿਤ ਨਾਥ ਜੋਗੀਆਂ ਤੋਂ ਲੈ ਕੇ ਆਧੁਨਿਕ ਸਾਹਿਤ ਤੱਕ ਮਿਲਦਾ ਹੈ ਨਾਥ ਜੋਗੀਆਂ ਤੋਂ ਬਾਅਦ ਸੂਫੀ ਮੱਤ ਗੁਰਮਤਿ ਕਾਵਿ ਅਤੇ ਆਧੁਨਿਕ ਸਾਹਿਤ ਵਿੱਚ ਸਾਨੂੰ ਬਹੁਤ ਸਾਹਿਤ ਲਿਖਿਆ ਮਿਲਦਾ ਹੈ ਪੰਜਾਬੀ ਭਾਸ਼ਾ ਦੀ ਹੋਰ ਕਲਾਤਮਕ ਪ੍ਰਗਟਾਵਿਆਂ ਵਿੱਚ ਜਿਵੇਂ ਭੰਗੜੇ ਬੋਲੀਆਂ ਗਿੱਧੇ ਦੀਆਂ ਬੋਲੀਆਂ ਅਤੇ ਹੋਰ ਗੀਤ ਅਖਾਣਾਂ ਅਖੌਤਾਂ ਮੁਹਾਵਰੇ ਬੁਝਾਰਤਾਂ ਆਦਿ ਵਿੱਚ ਮਿਲਦੀਆਂ ਪੰਜਾਬੀ ਭਾਸ਼ਾ ਉੱਚ ਪੱਧਰ ਅਤੇ ਵਿਕਸਿਤ ਹੋਣ ਕਰਕੇ ਇਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਲਹਿਜਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਇਸ ਵਿੱਚ ਜਿਵੇਂ ਮਾਝੀ ਮਾਲਵੀ ਦੁਆਬੀ ਪੋਠੋਹਾਰੀ ਮੁਲਤਾਨੀ ਝੰਗੀ ਆਦਿ ਭਾਸ਼ਾ ਆਉਂਦੀਆਂ ਹਨ ਇਹਨਾਂ ਭਾਸ਼ਾ ਵਿੱਚ ਵੱਖ ਵੱਖ ਗੁਣ ਹਨ